ਜਿਹੜਾ ਨਿਊਜ਼ ਮੀਡੀਆ ਹੈ ਉਹ ਬਹੁਤ ਵਧੀਆ ਰੋਲ ਨਿਭਾਉਂਦਾ ਏ ਕਿਸੇ ਵੀ ਚੀਜ਼ ਜੋ ਮੀਡੀਆ ਕੋਈ ਮੁੱਦੇ ਇੱਦਾਂ ਦੇ ਜਿਨ੍ਹਾਂ ਨੂੰ ਦਿਖਾਉਣ 'ਚ ਵਧੀਆ ਰੋਲ ਨਿਭਾਉਂਦਾ ਹੈ ਪਰ ਹੁਣ ਮੀਡੀਆ ਥੋੜ੍ਹਾ ਇੱਕ ਤਰ੍ਹਾਂ ਨਾਲ ਇੱਕ ਪਾਸਾ ਹੀ ਦਿਖਾਉਂਦਾ ਦੂਜਾ ਪਾਸਾ ਨਹੀਂ ਦਿਖਾਉਂਦਾ ਹਾਂਜੀ ਮੀਡੀਆ ਜਿਹੜਾ ਨਿਊਜ਼ ਮੀਡੀਆ ਉਹ ਪੇਂਡੂ ਖੇਤਰਾਂ ਬਾਰੇ ਕਾਫੀ ਮੁੱਦੇ ਦਿਖਾਉਂਦਾ ਹੈ ਪਰ ਕੁਝ ਇੱਦਾਂ ਦੇ ਮੁੱਦੇ ਜਿਨ੍ਹਾਂ ਬਾਰੇ ਲੋਕ ਗੱਲ ਹੀ ਨਹੀਂ ਕਰਦੇ ਜਿਵੇਂ ਕਿ ਸਭ ਤੋਂ ਵੱਡਾ ਮੁੱਦਾ ਜੇ ਆਪਾਂ ਗੱਲ ਕਰੀਏ ਤਾਂ ਜਿਹੜੀਆਂ ਪਿੰਡ ਪਿੰਡ ਦੇ ਵਿਕਾਸ ਦੀਆਂ ਕਿ ਆਹ ਚੀਜ਼ਾਂ ਨਹੀਂ ਹੋ ਰਹੀਆਂ ਇਹਨਾਂ ਬਾਰੇ ਤਾਂ ਪੇਂਡੂ ਖੇਤਰਾਂ ਬਾਰੇ ਕੁਝ ਦੱਸਦੇ ਨਹੀਂ ਹੈਗੇ ਇਹ ਦੱਸਦੇ ਰਹਿੰਦੇ ਆ ਖੇਤ 'ਚ ਇੰਨੀ ਬਿਜਾਈ ਹੋਈ ਇੱਧਰ ਇੰਨੀ ਕਣਕ ਹੋਈ ਕੁਝ ਇੱਦਾਂ ਦੀਆਂ ਚੀਜ਼ਾਂ ਥੋੜ੍ਹੀ ਨਾ ਦੱਸਣੀਆਂ ਚਾਹੀਦੀਆਂ ਇਹ ਦੱਸਣਾ ਚਾਹੀਦਾ ਕਿ ਇਹ ਲੋਕ ਦਿਖਾਓ ਸਰਕਾਰ ਨੂੰ ਕਿਹੜੇ ਪਿੰਡ ਦਾ ਵਿਕਾਸ ਨਹੀਂ ਹੋਇਆ ਕਿਹੜੇ ਪਿੰਡ 'ਚ ਮੁੱਦੇ ਇੱਦਾਂ ਦੇ ਕਿ ਨਸ਼ੇ ਦਾ ਮੁੱਦਾ ਕਿੰਨਾ ਹੈ ਉੱਥੇ ਦੀਆਂ ਸੜਕਾਂ ਖਰਾਬ ਨੇ ਉੱਥੇ ਦਾ ਪਾਣੀ ਨਹੀਂ ਜਾਂਦਾ ਉੱਥੇ ਬਿਜਲੀ ਨਹੀਂ ਆਉਂਦੀ ਉੱਥੇ ਆਵਾਜਾਈ ਦੇ ਸਾਧਨ ਨਹੀਂ ਇਹ ਜਿਹੇ ਮੁੱਦੇ ਤਾਂ ਨਿਊਜ਼ ਦਿਖਾ ਨਿਊਜ਼ ਮੀਡੀਆ ਦਿਖਾਉਂਦਾ ਹੀ ਨਹੀਂ ਨਿਊਜ਼ ਮੀਡੀਆ ਤਾਂ ਇੱਕ ਪਾਸੇ ਨੂੰ ਹੋ ਕੇ ਚੱਲਿਆ ਹੋਇਆ ਏ ਜੇ ਤਾਂ ਉਹ ਇੱਕ ਪੱਖ ਦੀ ਸੁਣ ਲੈਣ ਤਾਂ ਦੂਜੇ ਪੱਖ ਦੀ ਨਹੀਂ ਸੁਣਦਾ ਉਹਨੂੰ ਦੋਨਾਂ ਪੱਖਾਂ ਨੂੰ ਦੇਖ ਕੇ ਫਿਰ ਨਿਊਜ਼ ਦੇਣੀ ਚਾਹੀਦੀ ਹੈ ਬਹੁਤ ਸਾਰੇ ਇੱਦਾਂ ਦੇ ਹੋਰ ਮੁੱਦੇ ਨੇ ਜਿਵੇਂ ਕਿ ਕੋਈ ਪਿੰਡ 'ਚ ਗਰੀਬ ਬੰਦਾ ਏ ਉਹਦੀ ਗਰੀਬੀ ਬਹੁਤ ਉਹਦੀ ਹਾਲਤ ਬਹੁਤ ਗਰੀਬ ਵੀ ਹੈ ਤਾਂ ਉਹਨੂੰ ਨਿਊਜ਼ ਮੀਡੀਆ 'ਚ ਦਿਖਾਉਣਾ ਚਾਹੀਏ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਕਿਸ ਬੰਦੇ ਦੀ ਮਦਦ ਕਰੇ ਉਹਨੂੰ ਕਈ ਵਾਰ ਉਹ ਬੰਦਾ ਉੱਥੇ ਤੱਕ ਪਹੁੰਚ ਨਹੀਂ ਪਾਉਂਦਾ ਉਹਨੂੰ ਕੁਝ ਜੇ ਸਾਧਨ ਹੀ ਨਹੀਂ ਮਿਲਦੇ ਕਿਉਂਕਿ ਪਿੰਡਾਂ 'ਚ ਬੱਸਾਂ ਨਹੀਂ ਜਾਂਦੀਆਂ ਪਿੰਡਾਂ 'ਚ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਹੈ ਪਿੰਡਾਂ 'ਚ ਬਿਜਲੀ ਦੀ ਬਹੁਤ ਜ਼ਿਆਦਾ ਦਿੱਕਤ ਹੈ ਪਿੰਡਾਂ 'ਚ ਨੈਟਵਰਕ ਦੀ ਬਹੁਤ ਜ਼ਿਆਦਾ ਦਿੱਕਤ ਹੈ ਪਿੰਡਾਂ 'ਚ ਪੜ੍ਹਾਈ ਦੀ ਬਹੁਤ ਜ਼ਿਆਦਾ ਸਮੱਸਿਆ ਏ ਕਿਉਂਕਿ ਕੋਈ ਸਕੂਲ ਕਾਲਜ ਪਿੰਡਾਂ ਦੇ ਨੇੜੇ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ ਹੋ ਸਕਦਾ ਇਸ ਕਰਕੇ ਨਿਊਜ਼ ਮੀਡੀਆ ਨੂੰ ਇਹਨਾਂ ਸਾਰੀਆਂ ਚੀਜ਼ਾਂ ਅਤੇ ਇਹਨਾਂ ਸਾਰਿਆਂ ਮੁੱਦਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ